ਮੋਹਾਲੀ ਜ਼ਿਲ੍ਹਾ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਦਾ ਇਤਿਹਾਸ ਬਹੁਤ ਹੀ ਡੂੰਘਾ ਹੈ ਇਸ ਦਾ ਇਤਿਹਾਸ ਜਿਵੇਂ ਕਿ ਚੱਪੜਚਿੜੀ ਖੁਰਦ ਪੰਜਾਬ ਦੇ ਜ਼ਿਲ੍ਹੇ ਬਲਾਕ ਖਰੜ੍ਹ ਦਾ ਇੱਕ ਪਿੰਡ ਹੈ ਚੱਪੜਚਿੜੀ ਬਨੂੜ ਖਰੜ ਦਾ ਮੁੱਖ ਸੜਕ ਵਿੱਥ 'ਤੇ ਲਾਂਡਰਾ ਨੇੜੇ ਸਥਿਤ ਹੈ ਇਸ ਸੜਕ ਨੂੰ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਸ ਸੜਕ 'ਤੇ ਬੰਦਾ ਸਿੰਘ ਬਹਾਦਰ ਮੈਦਾਨ ਦਾ ਨਿਰੀਖਣ ਕੀਤਾ ਸੀ ਲੋਕਾਂ ਨੇ ਉਸ ਨੂੰ ਪੁੱਟ ਕੇ ਮੈਦਾਨ ਨੇੜੇ ਲੈ ਆਂਦਾ ਇਤਿਹਾਸਕ ਅਤੇ ਵਿਰਾਸਤ ਸਮੂਹ ਸਬੂਤ ਮਿਟਦੇ ਗਏ ਬਾਰ੍ਹਾਂ ਮਈ ਸਤਾਰਾਂ ਸੌ ਦਸ ਦੇ ਲਗਭਗ ਬੰਦਾ ਸਿੰਘ ਬਹਾਦਰ ਸਿੱਖ ਦੇ ਸਰਹੰਦ ਦੇ ਵਜ ਫੌਜਦਾਰ ਵਜ਼ੀਰ ਖਾਂ ਦੀਆਂ ਫੋਜਾਂ ਦੇ ਵਿਚਕਾਰ ਲੜਾਈ ਹੋਈ ਲੜਾਈ ਵਿੱਚ ਵਜ਼ੀਰ ਖਾਂ ਮਾਰਿਆ ਗਿਆ ਮੁਗਲ ਫੌਜ ਭਾਜੜਾਂ ਪੈ ਗਈਆਂ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨਾਲ ਜੋ ਗੁਜ਼ਰੀ ਸੋ ਗੁਜ਼ਰੀ ਬੰਦਾ ਸਿੰਘ ਬਹਾਦਰ ਦੀ ਦ੍ਰਿੜਤਾ ਅਤੇ ਸ਼ਕਤੀ ਦਾ ਅਜਿਹਾ ਨਿਰਮਾਣ ਹੁੰਦਾ ਸੀ ਦੇਵ ਕੱਦ ਜਰਨੈਲ ਦਾ ਰੂਪ ਧਾਰ ਲੈਂਦਾ ਇਹ ਯਾਦਗਾਰ ਸਿੱਖ ਫੌਜਾਂ ਦੀ ਸਰਹੰਦ ਦੇ ਨਵਾਬ ਨੂੰ ਜੰਗ ਵਿੱਚ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਹੋਈ ਜਿੱਤ ਦੀ ਯਾਦਗਾਰ ਵਿੱਚ ਬਣਾਈ ਗਈ ਫਤਿਹ ਫਤਿਹ ਬੁਰਜ ਵੀ ਉਸ ਹੈ ਚੱਪੜਚਿੜੀ ਦੇ ਯੁੱਧ ਦੀ ਜਿੱਤ ਤੋਂ ਬਾਅਦ ਸਰਹੰਦ ਦਾ ਪਹਿਲਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਬਣਾਇਆ ਗਿਆ